ਹਾਂਜੀ ਗੱਲ ਇਹ ਹੈ ਇੱਥੇ ਮਛੇਰੇ ਦੀਆਂ ਜਾਤਾਂ ਕੀ ਹਨ ਇੱਥੇ ਪੰਜਾਬ ਦੇ ਵਿੱਚ ਨਾ ਕੋਈ ਸਮੁੰਦਰ ਲੱਗਦਾ ਹੈ ਨਾ ਕੋਈ ਵੱਡਾ ਦਰਿਆ ਲੱਗਦਾ ਹੈ ਇੱਥੇ ਕੋਈ ਇੱਦਾਂ ਦੀ ਕੋਈ ਸਪੈਸ਼ਲ ਜਾਂ ਕੋਈ ਸਪੈਸ਼ਲ ਜਾਤ ਨਹੀਂ ਰਹਿੰਦੀ ਹੈ ਜੋ ਕਿ ਮੱਛੀਆਂ ਫੜਨ ਦਾ ਕੰਮ ਕਰਦੇ ਹੋਵੇ ਹਾਂ ਇੱਥੇ ਜ਼ਰੂਰ ਨੰਗਲ ਡੈਮ ਤੋਂ ਜ਼ਰੂਰ ਆਉਂਦੀ ਜ਼ ਮੱਛੀ ਉਹ ਵੀ ਉਹ ਉਹਨਾਂ ਦਾ ਕਿੱਤਾ ਉਹਨਾਂ ਦਾ ਇਹ ਕਿੱਤਾ ਹੈ ਉਹਨਾਂ ਤੋਂ ਉਹ ਜਿਵੇਂ ਕਹਿ ਦੇ ਨੇ ਜੋਬ ਕਰਦੇ ਹਨ ਉੱਥੇ ਨੌਕਰੀ ਕਰਦੇ ਹਨ ਮੱਛੀਆਂ ਫੜਦੇ ਹਨ ਅਤੇ ਉਹ ਇੱਧਰ ਆਪਣੇ ਪੰਜਾਬ ਦੇ ਵਿੱਚ ਇੱਧਰ ਸਪਲਾਈ ਕਰ ਦਿੰਦੇ ਹਨ ਇਹ ਮਛੇਰਿਆਂ ਦੀਆਂ ਜਾਤਾਂ ਜੋ ਕਿ ਖਾਨਦਾਨੀ ਜਾਤਾਂ ਜੋ ਕਿੱਤਾ ਮੰਨਿਆ ਜਾਂਦਾ ਹੈ ਉਹ ਮੰਨਿਆ ਜਾਂਦਾ ਹੈ ਮਹਾਰਾਸ਼ਟਰ ਦੇ ਵਿੱਚ ਗੋਆ ਦੇ ਵਿੱਚ ਜਿੱਥੇ ਕਿ ਸਮੁੰਦਰ ਦਾ ਟਾ ਤੱਟ ਨਾਲ ਲੱਗਦਾ ਹੈ ਸਾਡੇ ਇੱਦਾਂ ਦਾ ਸਮੁੰਦਰ ਦਾ ਤੱਟ ਨਾ ਲੱਗਣ ਕਰਕੇ ਸਾਡੇ ਇੱਦਾਂ ਦੀ ਇੱਥੇ ਕੋਈ ਜਾਤ ਨਹੀਂ ਰਹਿੰਦੀ ਸਾਡੇ ਸਿਰਫ ਨੌਕਰੀ ਪੇਸ਼ਾ ਕਰਕੇ ਉਹਨਾਂ ਨੇ ਆਪਣੇ ਰੋਜ਼ਗਾਰ ਦਾ ਸਾਧਨ ਬਣਾਇਆ ਵਾ ਹੈ ਜੋ ਕਿ ਨੰਗਲ ਡੈਮ ਦੇ ਵਿੱਚ ਸਾਨੂੰ ਇੱਕ ਡੈਮ ਲੱਗਦਾ ਹੈ ਉੱਥੋਂ ਸਪਲਾਈ ਹੁੰਦੀ ਹੈ ਮੱਛੀਆਂ ਦੀ ਉਹ ਸਾਨੂੰ ਇੱਥੇ ਲੋਕਲ ਮਾਰਕੀਟ ਦੇ ਵਿੱਚ ਮੱਛੀਆਂ ਆ ਜਾਂਦੀਆਂ ਹਨ ਅਤੇ ਅਸੀਂ ਉਹ ਖਾ ਲੈਂਦੇ ਹਾਂ ਬਸ